ਖਬਰਾਂ ਅਤੇ ਮੀਡੀਆ ਯੂ ਪੀ ਐੱਸ ਸੀ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਚਾਹਵਾਨਾਂ ਲਈ ਜਾਣਕਾਰੀ ਦੇ ਮਹੱਤਵਪੂਰਨ ਸਰੋਤ ਹਨ ਉਹ ਮੌਜੂਦਾ ਮਾਮਲਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਅਤੇ ਸਿਲੇਬਸ ਨਾਲ ਸੰਬੰਧਿਤ ਵੱਖ ਵੱਖ ਵਿਸ਼ਿਆਂ ਨਾਲ ਅਪਡੇਟ ਰਹਿਣ ਵਿੱਚ ਉਹਨਾਂ ਦੀ ਮਦਦ ਕਰਦੇ ਹਨ ਖਬਰਾਂ ਅਤੇ ਮੀਡੀਆ ਉਹਨਾਂ ਦੇ ਵਿਸ਼ੇਸ਼ਆਤਮਕ ਅਤੇ ਆਲੋਚਨਾਤਮਕ ਸੋਚ ਅਤੇ ਹੁਨਰ ਨੂੰ ਵਿਕਸਿਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਕਿਉਂਕਿ ਉਹ ਵੱਖ ਵੱਖ ਸਰੋਤਾਂ ਦੁਆਰਾ ਪੇਸ਼ ਕੀਤੇ ਗਏ ਵੱਖੋ ਵੱਖ ਦ੍ਰਿਸ਼ਟੀਕੋਣਾਂ ਵਿਚਾਰਾਂ ਅਤੇ ਤੱਥਾਂ ਨੂੰ ਤੁਲਨਾ ਕਰਦੇ ਹਨ ਖਬਰਾਂ ਅਤੇ ਮੀਡੀਆ ਉਨ੍ਹਾਂ ਦੇ ਸੰਚਾਰ ਅਤੇ ਲਿਖਣ ਦੇ ਹੁਨਰ ਨੂੰ ਵੀ ਵਧਾਉਂਦੇ ਹਨ ਕਿਉਂਕਿ ਉਹ ਆਪਣੇ ਵਿਚਾਰਾਂ ਨੂੰ ਸਪਸ਼ਟ ਸੰਖੇਪ ਅਤੇ ਯਕੀਨ ਤਰੀਕੇ ਨਾਲ ਪ੍ਰਗਟ ਕਰਨਾ ਸਿੱਖ ਸਕਦੇ ਹਨ ਖਬਰਾਂ ਅਤੇ ਮੀਡੀਆ ਨਾ ਸਿਰਫ ਜਰਨਲ ਸਟੱਡੀਜ਼ ਦੇ ਪੇਪਰ ਤਿਆਰੀ ਲਈ ਸਗੋਂ ਵਿਕਲਪਿਕ ਵਿਸ਼ਿਆਂ ਲੇਖ ਦੇ ਪੇਪਰ ਅਤੇ ਇੰਟਰਵਿਊ ਵਿੱਚ ਲਾਭਦਾਇਕ ਹੁੰਦੀਆਂ ਹਨ ਖਬਰਾਂ ਅਤੇ ਮੀਡੀਆ ਨੂੰ ਨਿਯਮਿਤ ਤੌਰ 'ਤੇ ਪੜ੍ਹਨ ਅਤੇ ਦੇਖ ਕੇ ਚਾਹਵਾਨ ਆਪਣੇ ਗਿਆਨ ਦੇ ਆਧਾਰ ਨੂੰ ਵਧਾ ਸਕਦੇ ਹਨ ਆਪਣੀ ਸ਼ਬਦਾਵਲੀ ਨੂੰ ਅਮੀਰ ਬਣਾ ਸਕਦੇ ਹਨ ਅਤੇ ਆਪਣੇ ਵਿਸ਼ਵਾਸ ਨੂੰ ਵੀ ਕਈ ਜ਼ਿਆਦਾ ਹੱਦ ਤੱਕ ਸੁਧਾਰ ਵੀ ਸਕਦੇ ਹਨ ਧੰਨਵਾਦ